ਜੀ ਹਾਂ ਮੈਂ ਪੇਂਟਿੰਗ ਵੀ ਕੀਤੀ ਹੈ ਆਪਣੇ ਫਰੈਂਡ ਨੂੰ ਮੈਰਿਜ 'ਤੇ ਤੋਹਫਾ ਦਿੱਤਾ ਹੈ ਆਪਣੀ ਪੇਂਟਿੰਗ ਦਾ ਜੋ ਕਿ ਮੈਨੂੰ ਬਹੁਤ ਪਿਆਰਾ ਹੈ ਕਿਉਂਕਿ ਆਪਣੇ ਹੱਥ ਦੀ ਬਣਾਈ ਚੀਜ਼ ਦੀ ਖੁਸ਼ੀ ਵੱਖਰੀ ਹੀ ਹੁੰਦੀ ਹੈ ਮੈਂ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਕੋਈ ਵੀ ਗਿਫਟ ਦੇਣਾ ਹੋਵੇ ਆਪਣੀ ਹੱਥ ਦੀ ਬਣਾਈ ਪੇਂਟਿੰਗ ਹੀ ਦਿੰਦੀ ਹਾਂ ਸਾਰੇ ਪਸੰਦ ਵੀ ਕਰਦੇ ਹਨ ਅਤੇ ਸਭ ਨੇ ਆਪਣੇ ਡਰਾਇੰਗ ਰੂਮ ਵਿੱਚ ਸਜਾਈ ਹੋਈ ਹੈ ਮੈਨੂੰ ਬਹੁਤ ਔਡਰ ਵੀ ਮਿਲਦੇ ਹਨ ਲੋਕ ਕਹਿੰਦੇ ਹਨ ਕਿ ਅਸੀਂ ਬੇਟੀ ਦੇ ਵਿਆਹ 'ਤੇ ਤੁਹਾਡੇ ਹੱਥ ਦੀ ਬਣੀ ਹੋਈ ਪੇਂਟਿੰਗ ਜ਼ਰੂਰ ਦੇਣੀ ਹੈ ਮਿਊਜ਼ੀਅਮ ਵਿੱਚ ਵੀ ਮੇਰੀ ਪੇਂਟਿੰਗ ਬਹੁਤ ਪਸੰਦ ਕੀਤੀ ਜਾਂਦੀ ਹੈ ਮੈਂ ਪੇਂਟਿੰਗ ਸੇਲ ਵੀ ਕਰਦੀ ਹਾਂ ਲੋਕ ਮੈਨੂੰ ਮੂੰਹ ਮੰਗੇ ਪੈਸੇ ਵੀ ਦਿੰਦੇ ਹਨ ਮੈਨੂੰ ਬਹੁਤ ਪ੍ਰੋਫਿਟ ਵੀ ਹੁੰਦਾ ਹੈ ਮੈਂ ਸਕੂਲ ਟਾਈਮ 'ਤੇ ਆਪਣੇ ਟੀਚਰ ਨੂੰ ਕਾਰਡ ਬਣਾ ਕੇ ਹਮੇਸ਼ਾ ਟੀਚਰ ਡੇਅ 'ਤੇ ਦਿੰਦੀ ਸੀ ਮੰਮਾ ਪਾਪਾ ਨੂੰ ਮੈਰਿਜ ਐਨਵਰਸਰੀ 'ਤੇ ਵੀ ਕਾਰਡ ਬਣਾ ਕੇ ਦਿੰਦੀ ਸੀ ਉਹ ਬਹੁਤ ਖੁਸ਼ ਹੁੰਦੇ ਸਨ ਅਤੇ ਪਿਆਰ ਕਰਦੇ ਸਨ ਹੁਣ ਮੇਰੇ ਬੱਚੇ ਵੀ ਟੀਚਰ ਨੂੰ ਟੀਚਰ ਡੇਅ 'ਤੇ ਕਾਰਡ ਬਣਾ ਕੇ ਦਿੰਦੇ ਹਨ ਅਤੇ ਸਾਨੂੰ ਵੀ ਦਿੰਦੇ ਹਨ ਸਾਡੀ ਮੈਰਿਜ ਐਨਵਰਸਰੀ 'ਤੇ ਕਿਉਂਕਿ ਹੱਥ ਦੀ ਬਣਾਈ ਚੀਜ਼ ਵਿੱਚ ਬਹੁਤ ਪਿਆਰ ਭਰਿਆ ਹੁੰਦਾ ਹੈ